ਹੈਲੋ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਜੋ ਮੈਂ ਤੁਹਾਡੇ ਐਮੇਜਾਨ ਤੋਂ ਪ੍ਰੋਡਕਟ ਅਪਲਾਈ ਕੀਤਾ ਸੀ ਜਿਵੇਂ ਕਿ ਮੰਨ ਲਓ ਮੋਬਾਈਲ ਫੋਨ ਉਹ ਮੈਨੂੰ ਮਿਲ ਚੁੱਕਿਆ ਸਰ ਹਾਂਜੀ ਅਤੇ ਮੋਬਾਈਲ ਓਪੋ ਰੈਨੋ ਫਾਈਵ ਜੀ ਕੀਤਾ ਸੀ ਮੈਂ ਓਪੋ ਰੈਨੋ ਫਾਈਵ ਜੀ ਮੈਨੂੰ ਮਿਲ ਚੁੱਕਿਆ ਹੈਗਾ ਅਤੇ ਸਰ ਉਹਦੀ ਪੈਕਿੰਗ ਬਹੁਤ ਵਧੀਆ ਸੀਗੀ ਜਿਸ ਤਰ੍ਹਾਂ ਮੈਂ ਉਹਨੂੰ ਦੇਖ ਕੇ ਮੰਨ ਲਓ ਉਹਦੇ ਫੀਚਰਸ ਦੇਖ ਕੇ ਤੁਹਾਨੂੰ ਅਪਲਾਈ ਕੀਤਾ ਸੀਗਾ ਅਤੇ ਮੈਨੂੰ ਬਹੁਤ ਵਧੀਆ ਲੱਗਿਆ ਹਾਂਜੀ ਉਹਦੇ ਫੀਚਰਸ ਵੀ ਵਧੀਆ ਹੈਗੇ ਆ ਜਿਸ ਤਰ੍ਹਾਂ ਕਿ ਉਹਦਾ ਪ੍ਰੋਸੈਸਰ ਹੈਗਾ ਹਜ਼ਾਰ ਓਕਟਾਕੋਰ ਅਤੇ ਮੰਨ ਲਓ ਰੈਮ ਉਹਦੀ ਅੱਠ ਜੀ ਬੀ ਹੈ ਇੱਕ ਸੌ ਅਠਾਈ ਜੀ ਬੀ ਮੈਂਬਰੀ ਹੈ ਅਤੇ ਸੋਲ੍ਹਾਂ ਪੁਆਇੰਟ ਸੱਠ ਉਹਦੀ ਸਕਰੀਨ ਸਾਈਜ ਆ ਸੈਂਟੀਮੀਟਰ ਸਰ ਮੈਨੂੰ ਤੁਹਾਡਾ ਪ੍ਰੋਡਕਟ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਸਰ ਜਿਸ ਤਰ੍ਹਾਂ ਮੈਂ ਅਪਲਾਈ ਕੀਤਾ ਸੀਗਾ ਸੈਂਡ ਕੀਤਾ ਸੀ ਮੰਗਵਾਉਣ ਲਈ ਉਸ ਤਰ੍ਹਾਂ ਮੈਨੂੰ ਬਹੁਤ ਵਧੀਆ ਹੀ ਲੱਗਿਆ ਅਤੇ ਸਰ ਮੈਂ ਫਸਟ ਟਾਈਮ ਮੰਨ ਲਓ ਪ੍ਰੋਡੈਕਟ ਤੁਹਾਡੇ ਤੋਂ ਮੰਗਵਾਇਆ ਸੀਗਾ ਇਹਦੇ ਫੀਚਰਸ ਵੀ ਬਹੁਤ ਵਧੀਆ ਹੈਗੇ ਆ ਅਤੇ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਤੁਸੀਂ ਤਾਂ ਘੱਟ ਤੋਂ ਘੱਟ ਸਮੇਂ ਦੇ ਵਿੱਚ ਹੀ ਮੈਨੂੰ ਮੇਰਾ ਪ੍ਰੋਡੈਕਟ ਮੇਰਾ ਮੋਬਾਈਲ ਫੋਨ ਮੈਨੂੰ ਘਰ ਪਹੁੰਚਾ ਦਿੱਤਾ ਅਤੇ ਇਹਦੀ ਪੈਕਿੰਗ ਵੀ ਬਹੁਤ ਵਧੀਆ ਸੀਗੀ ਸਰ ਇਹ ਮੋਬਾਈਲ ਹੈਗਾ ਓਪੋ ਰੈਨੋ ਫਾਈਵ ਜੀ ਅਤੇ ਫਾਈਵ ਜੀ ਨੈਟਵਰਕ ਆ ਰਿਹਾ ਹੈਗਾ ਗੱਲ ਬਹੁਤ ਵਧੀਆ ਹੋ ਰਹੀ ਆ ਅਤੇ ਇਹਦੇ ਚੱਲਣ ਵਿੱਚ ਵੀ ਕੋਈ ਦਿੱਕਤ ਨਹੀਂ ਕੋਈ ਹੈਂਗ ਨਹੀਂ ਹੁੰਦਾ ਹੈਗਾ ਮੈਂ ਕਹਿੰਦਾ ਜਿਸ ਤਰ੍ਹਾਂ ਮੈਂ ਫਸਟ ਟਾਈਮ ਥੋ ਤੁਹਾਡੇ ਤੋਂ ਮੋਬਾਈਲ ਮੰਗਵਾਇਆ ਐਮਾਜ਼ੋਨ ਤੋਂ ਅਪਲਾਈ ਕਰਕੇ ਮੋਬਾਈਲ ਮੰਗਵਾਇਆ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਿਆ ਮੈਂ ਇਸ ਤੋਂ ਬਹੁਤ ਹੀ ਖੁਸ਼ ਹਾਂ ਹਾਂਜੀ ਸਰ